ਟਰੈਕ ਟਰੈਕ ਜਿਹੜਾ ਪਹਾੜੜਾਂ 'ਤੇ ਟਰੈਕ ਕਰਨਾ ਟਰੈਕਿੰਗ ਕਰਨੀ ਮੰਨ ਲਓ ਵੀ ਪਹਾੜ ਚੜ੍ਹਨਾ ਉਹ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈਗਾ ਵੱਖਰਾ ਨਜ਼ਾਰਾ ਇਸ ਤਰ੍ਹਾਂ ਹੁੰਦਾ ਵੀ ਇੱਕ ਵਾਰ ਅਸੀਂ ਹਿਮਾਚਲ ਦੇ ਵਿੱਚ ਗਏ ਟਰੈਕਿੰਗ ਦੇ ਲਈ ਸ਼ਪੈਸ਼ਲ ਅਸੀਂ ਚਾਰ ਜਣੇ ਪੰਜ ਜਣੇ ਸੀਗੇ ਚਲੋ ਛੁੱਟੀਆਂ ਵੀ ਸੀਗੀਆਂ ਅਤੇ ਅਸੀਂ ਟਰੈਕਿੰਗ ਦੇ ਲਈ ਹਿਮਾਚਲ ਚਲੇ ਗਏ ਤਾਂ ਜਦੋਂ ਅਸੀਂ ਟਰੈਕਿੰਗ ਸ਼ੁਰੂ ਕੀਤੀ ਤਾਂ ਕੁਛ ਦੂਰੀ ਤੈਅ ਕਰਨ ਦੇ ਬਾਵਜੂਦ ਜਦੋਂ ਕਿ ਉੱਪਰ ਨੂੰ ਚੜ੍ਹਦੇ ਗਏ ਚੜ੍ਹਦੇ ਗਏ ਚੜ੍ਹਦੇ ਗਏ ਤਾਂ ਉੱਪਰ ਕੀ ਹੁੰਦਾ ਵੀ ਜਿਵੇਂ ਜਿਵੇਂ ਅਸੀਂ ਉੱਪਰ ਜਾਂਦੇ ਹਾਂ ਤਾਂ ਜਿਹੜੀ ਆਕਸੀਜਨ ਆ ਸਾਨੂੰ ਆਕਸੀਜਨ ਦੀ ਕਮੀ ਨਾ ਮਹਿਸੂਸ ਹੋਣ ਲੱਗ ਜਾਂਦੀ ਸਾਹ ਜਿਹੜਾ ਆਪਣਾ ਉਹ ਫੁੱਲਣ ਲੱਗ ਜਾਂਦਾ ਗਾ ਸਾਹ ਫੁੱਲਣ ਤੋਂ ਬਾਅਦ ਜੋ ਬੰਦੇ ਦੇ ਨਾਲ ਕੇਰਾ ਹੁੰਦਾ ਗਾ ਤਾਂ ਮਨ ਦੇ ਵਿੱਚ ਸੋਚ ਕੇ ਲੱਗਦਾ ਵੀ ਯਾਰ ਕਿੱਥੇ ਆਪਾਂ ਇਹ ਪੰਗਾ ਲੈ ਲਿਆ ਪਰ ਜਿਹੜਾ ਉਸ ਤੋਂ ਬਾਅਦ ਦਾ ਨਜ਼ਾਰਾ ਉਹ ਕੁਛ ਵੱਖਰਾ ਹੀ ਹੁੰਦਾ ਕਿਉਂਕਿ ਸਾਹ ਫੁੱਲਣ ਦੇ ਨਾਲ ਜਦੋਂ ਆਪਾਂ ਚੜ੍ਹਦੇ ਹਾਂ ਦਮ ਵੀ ਚੜ੍ਹਦਾ ਆਪਣਾ ਹੈ ਨਾ ਅਤੇ ਅਜੀਬ ਅਜੀਬ ਜਿਹੇ ਖਿਆਲ ਵੀ ਆਉਂਦੇ ਹੈ ਅਤੇ ਜਦੋਂ ਆਪਾਂ ਨੀਚੇ ਵੀ ਦੇਖਦੇ ਹਾਂ ਤਾਂ ਨੀਚੇ ਥੋੜ੍ਹਾ ਜਿਹਾ ਵਿਊ ਆ ਜਿਹੜਾ ਉਹ ਵੱਖਰਾ ਦਿਸਦਾ ਹੈਗਾ ਡਰਾਉਣਾ ਜਿਹਾ ਕਿਉਂਕਿ ਇੱਕ ਪਾਸੇ ਡੂੰਘਾਈ ਵੀ ਹੁੰਦੀ ਹੈਗੀ ਪੈਰ ਫਿਸਲਣ ਦਾ ਵੀ ਡਰ ਹੁੰਦਾ ਹੈਗਾ ਅਤੇ ਜਿਸ ਟਾਈਮ ਆਪਾਂ ਪਹਾੜ ਦੇ ਉੱਪਰ ਜਿੱਥੇ ਜਾਣਾ ਹੁੰਦਾ ਗਾ ਕੁਛ ਘੰਟਿਆਂ ਬਾਅਦ ਯਾਨੀ ਕਿ ਆਰਾਮਦਾਰੀ ਦੇ ਨਾਲ ਉੱਥੇ ਜਦੋਂ ਪਹੁੰਚ ਜਾਂਦੇ ਹਾਂ ਆਪਾਂ ਹੈ ਨਾ ਤਾਂ ਉੱਥੇ ਜਾ ਕੇ ਕਿਹੜਾ ਵਿਊ ਬਣਦਾ ਦ੍ਰਿਸ਼ ਬਣਦਾ ਉਹ ਵੱਖਰਾ ਹੀ ਹੁੰਦਾ ਉਸ ਟਾਈਮ ਜਦੋਂ ਅਸੀਂ ਪਹੁੰਚੇ ਤਾਂ ਇੱਕ ਤਾਂ ਸੂਰਜ ਦਾ ਡੁੱਬਣਾ ਯਾਣੀ ਕਿ ਸੂਰਜ ਛਿਪ ਰਿਹਾ ਸੀਗਾ ਅਤੇ ਜਿਹੜਾ ਉਹ ਸੂਰਜ ਛਿਪਣ ਦਾ ਵਿਊ ਬਣਿਆ ਉਹ ਇੱਕ ਦੇਖਣਯੋਗ ਸੀਗਾ ਆਸੇ ਪਾਸੇ ਜਿਹੜੇ ਪਹਾੜ ਸੀਗੇ ਤਾਂ ਉਹ ਵੀ ਦੇਖ ਕੇ ਮਨ ਬਹੁਤ ਖੁਸ਼ ਹੋਇਆ ਕਿਉਂਕਿ ਜਿਹੜਾ ਥੱਲਿਓਂ ਨੀਚਿਓਂ ਚੜ੍ਹਨ ਦਾ ਮਾਹੌਲ ਸੀ ਉਹ ਹੋਰ ਸੀ ਪਰ ਜਿਹੜਾ ਉੱਪਰ ਜਾ ਕੇ ਟਰੈਕਿੰਗ ਪੂਰੀ ਕਰਕੇ ਪਹਾੜ ਦੀ ਤਾਂ ਜਿਹੜਾ ਸਾਨੂੰ ਆਨੰਦ ਮਿਲਿਆ ਉਹ ਇੱਕ ਬਹੁਤ ਹੀ ਵੱਖਰਾ ਅਨੰਦ ਸੀ ਅਤੇ ਬਹੁਤ ਹੀ ਮਜ਼ਾ ਆਇਆ ਉਸ 'ਚ ਹੈ ਨਾ ਇਸ ਤੋਂ ਬਾਅਦ ਵੀ ਅਸੀਂ ਸੋਚਿਆ ਵੀ ਹਾਂ ਕੇਰਾਂ ਹੀ ਡਰ ਲੱਗਦਾ ਸੀ ਪਰ ਇਸ ਤੋਂ ਬਾਅਦ ਅਸੀਂ ਇੱਕ ਵਾਰ ਹੋਰ ਟਰੈਕਿੰਗ 'ਤੇ ਵਾਪਸ ਆਵਾਂਗੇ